ਭੰਗੜਾ ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਹੈ ਭੰਗੜੇ ਤੋਂ ਬਿਨਾਂ ਸਾਡੇ ਕਈ ਤਿਉਹਾਰ ਅਧੂਰੇ ਹਨ ਸਾਡੇ ਹਰ ਤਿਉਹਾਰ ਭੰਗੜੇ ਦੇ ਨਾਲ ਹੀ ਪੂਰੇ ਹੁੰਦੇ ਹਨ ਭੰਗੜੇ ਵਿੱਚ ਕਈ ਤਰ੍ਹਾਂ ਦੇ ਸਟੈਪ ਭੰਗੜੇ ਕਈ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਕਿ ਝੂਮਰ ਗਿੱਧਾ ਟੱਪੇ ਸਿੱਠਣੀਆਂ ਅਤੇ ਇਸ ਤੋਂ ਬਿਨਾਂ ਸਾਡਾ ਸਾਰਾ ਫੰਕਸ਼ਨ ਅਧੂਰਾ ਹੁੰਦੇ ਆ ਹਰੇਕ ਫੰਕਸ਼ਨ ਅਧੂਰਾ ਰਹਿ ਜਾਂਦਾ ਹੈ ਹਰੇਕ ਤਿਉਹਾਰ 'ਤੇ ਦਿਨ ਤਿਉਹਾਰ 'ਤੇ ਸਾਡੇ ਸ਼ ਦੇਸ਼ ਦੇ ਮੁੰਡੇ ਕੁੜੀਆਂ ਭੰਗੜਾ ਪਾਉਂਦੇ ਹਨ ਝੂਮਰ ਪਾਉਂਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ ਬੱਚੇ ਸਕੂਲ ਦੇ ਵਿੱਚ ਫੈਸਟੀਵਲ ਵਾ ਕੇ ਫਿਟਨੈਸ ਭੰਗੜਾ ਪਾ ਕੇ ਫਿਟਨੈਸ ਵਧੀਆ ਰਹਿੰਦੀ ਹੈ ਕੁੜੀਆਂ ਗਿੱਧਾ ਕਰਦੀ ਹਨ ਜਿਸ ਨਾਲ ਫਿਟਨੈਸ ਵਧੀਆ ਰਹਿੰਦੀ ਹੈ ਇੱਕ ਤਰ੍ਹਾਂ ਦੀ ਭੰਗੜੇ ਦੇ ਨਾਲ ਸਕੂਲ ਵਿੱਚ ਭੰਗੜਾ ਕਰਨਾ ਐਕਸਰਸਾਈਜ਼ ਵੀ ਹੁੰਦੀ ਹੈ ਬੱਚਿਆਂ ਦੀ